ਸਾਈਕਲ ਚਲਾਉਂਦੇ ਸਮੇਂ ਸਾਨੂੰ ਸਾਈਕਲ ਦੇ ਹੈਂਡਲ ਤੋਂ ਹੱਥ ਨਹੀਂ ਛੱਡਣਾ ਚਾਹੀਦਾ ਸਾਈਕਲ ਚਲਾਉਂਦੇ ਸਮੇਂ ਸਾਨੂੰ ਸੜਕ ਦੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਸਾਈਕਲ ਤੇਜ਼ ਨਹੀਂ ਚਲਾਉਣਾ ਚਾਹੀਦਾ ਸਾਨੂੰ ਸਾਈਕਲ ਚਲਾਉਂਦੇ ਸਮੇਂ ਇੱਧਰ ਉੱਧਰ ਨਹੀਂ ਦੇਖਣਾ ਚਾਹੀਦਾ ਸੜਕ ਤੋਂ ਮੋੜ ਕੱਟਦੇ ਸਮੇਂ ਸਾਨੂੰ ਸਾਈਕਲ ਦੀ ਘੰਟੀ ਵਜਾਉਣੀ ਚਾਹੀਦੀ ਹੈ ਸਾਈਕਲ ਚਲਾਉਣ ਦੇ ਸਾਨੂੰ ਬਹੁਤ ਫਾਇਦੇ ਹਨ ਜਿਵੇਂ ਕਿ ਸਰੀਰਕ ਅਤੇ ਮਾਨਸਿਕ ਸਿਹਤ ਦੇ ਲਈ ਸਾਈਕਲ ਚਲਾਉਣਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਸਾਈਕਲ ਚਲਾਉਂਦੇ ਸਮੇਂ ਸਾਨੂੰ ਟਰੈਫਿਕ ਵਿੱਚ ਸਾਈਕਲ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ ਜ਼ਿਆਦਾ ਟਰੈਫਿਕ ਦੇਖ ਕੇ ਗੱਡੀਆਂ ਦੇਖ ਕੇ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਸਾਈਕਲ ਨੂੰ ਬਹੁਤ ਹੀ ਧਿਆਨ ਨਾਲ ਚਲਾਉਣਾ ਚਾਹੀਦਾ